ਮੈਨੂੰ ਖਾਣਾ ਬਹੁਤ ਹਲਵਾ ਪੂਰੀ ਚਾਵਲ ਰਾਇਤਾ ਹਰੀਆਂ ਸਬਜ਼ੀਆਂ ਦਾਲਾਂ ਬਹੁਤ ਪਸੰਦ ਨੇ ਇਹ ਕਿਉਂ ਪਸੰਦ ਨੇ ਮੇਰੇ ਪਰਿਵਾਰ ਨੂੰ ਵੀ ਇਹ ਬਹੁਤ ਪਸੰਦ ਹੈ ਕਿਉਂ ਇਹ ਕਿਉਂ ਕਿ ਮੇਰਾ ਪਰਿਵਾਰ ਵੀ ਬੜਾ ਖੁਸ਼ ਹੋ ਕੇ ਖਾਂਦਾ ਹੈ ਅਤੇ ਮੈਨੂੰ ਬਣਾਉਣ 'ਚ ਬੜੀ ਖੁਸ਼ੀ ਮਿਲਦੀ ਹੈ ਜਦੋਂ ਮੇਰਾ ਸਾਰਾ ਪਰਿਵਾਰ ਖੁਸ਼ ਹੋ ਕੇ ਖਾਂਦਾ ਹੈ ਨਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਇਸ ਕਾਰਨ ਬੜੇ ਸ਼ੌਕ ਨਾਲ ਬਣਾ ਕੇ ਦਿੰਦੀ ਹਾਂ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ